ਹਾਂਜੀ ਸਾਡੇ ਕੁਛ ਰਵਾਇਤੀ ਭੋਜਨ ਨੇ ਖੀਰ ਪੁੜੇ ਹੋਏ ਮਿੱਠੇ ਚੌਲ ਹੋਏ ਖੱਟੇ ਰੰਗ ਦੇ ਖੱਟੇ ਚੌਲ ਜਿਹੜੇ ਉਹ ਵਿਸਾਖੀ 'ਤੇ ਬਣਾਏ ਜਾਂਦੇ ਨੇ ਖੱਟਾ ਰੰਗ ਪਾ ਕੇ ਚੌਲ ਪਾ ਕੇ ਖੰਡ ਪਾ ਕੇ ਘਿਓ ਪਾ ਕੇ ਉਹਨਾਂ ਨੂੰ ਤਿਆਰ ਕੀਤਾ ਜਾਂਦਾ ਵਾ ਅਤੇ ਮਿੱਸੇ ਪ੍ਰਸ਼ਾਦੇ ਵੀ ਬਣਾਏ ਜਾਂਦੇ ਨੇ ਬਾਬਾ ਬੁੱਢਾ ਸਾਹਿਬ ਵਿਖੇ ਖੰਡ ਦੇ ਆਟੇ ਵਿੱਚ ਬੇਸਣ ਅਤੇ ਮਿਲਾ ਕੇ ਉਹਨਾਂ ਨੂੰ ਪਕਾਇਆ ਜਾਂਦਾ ਏ ਅਤੇ ਗੁਰੂ ਸਾਹਿਬ ਦੇ ਘਰ ਲਿਜਾਇਆ ਜਾਂਦਾ ਹੈ ਜਿਹੜੇ ਖੀਰ ਪੂੜੇ ਹੈ ਸਾਉਨ ਵਿੱਚ ਖਾਏ ਜਾਂਦੇ ਆ ਅਤੇ ਬੇਸਣ ਲੈ ਅ ਆਟਾ ਲੈ ਕੇ ਉਹਦੇ ਵਿੱਚ ਖੰ ਗੁੜ ਪਾ ਕੇ ਉਹ ਨੂੰ ਘੋਲ ਕੇ ਅਤੇ ਤਵੇ 'ਤੇ ਤਿਆਰ ਕਰਕੇ ਪਕਾਏ ਜਾਂਦੇ ਨੇ ਅਤੇ ਖਾਧੇ ਜਾਂਦੇ ਨੇ ਅਤੇ ਖੀਰ ਦੁੱਧ ਚੌਲ ਪਾ ਕੇ ਬਣਾਈ ਜਾਂਦੀ ਹੈ ਅਤੇ ਸਾਰੀਆਂ ਧੀਆਂ ਤਰਿੰਜਣਾਂ ਇਕੱਠੀਆਂ ਹੋ ਕੇ ਖਾਂਦੀਆਂ ਨੇ ਮੱਕੀ ਦੀ ਰੋਟੀ ਵੀ ਬਣਾਈ ਜਾਂਦੀ ਹੈ ਅਤੇ ਸਾਗ ਸਰਸੋਂ ਦਾ ਸਾਗ ਵੀ ਤਿਆਰ ਕੀਤਾ ਜਾਂਦਾ ਨਾਲ ਲੱਸੀ ਬਣਾਈ ਜਾਂਦੀ ਹੈ ਅਤੇ ਉਹਨਾਂ ਨੂੰ ਖਾਧਾ ਵੀ ਮੱਕੀ ਦੀ ਰੋਟੀ ਨੂੰ ਅਤੇ ਸਾਗ ਨੂੰ ਖਾ ਕੇ ਇੰਜੋਏ ਕੀਤਾ ਜਾਂਦਾ ਅਤੇ ਖੁਸ਼ੀ ਮਨਾਈ ਜਾਂਦੀ ਹੈ ਲੱਸੀ ਵੀ ਤਿਆਰ ਕੀਤੀ ਜਾਂਦੀ ਅਤੇ ਪੀਤੀ ਜਾਂਦੀ ਹੈ ਅਤੇ ਇਸ ਤਰ੍ਹਾਂ ਹੀ ਸਾਡੇ ਉੱਥੇ ਇੱਕ ਨਾ ਛੋਟਾ ਜਿਹਾ ਢਾਬਾ ਬਣਿਆ ਹੋਇਆ ਏ ਤਰਨ ਤਾਰਨ ਵਿੱਚ ਹਵੇਲੀ ਢਾਬਾ ਉੱਥੇ ਜਾ ਕੇ ਖਾਣਾ ਪਸੰਦ ਕਰਦੇ ਨੇ ਲੋਕ ਅਤੇ ਅਸੀਂ ਪਸੰਦ ਕਰਦੇ ਹਾਂ ਖਾਣਾ ਚਾਹੁੰਦੇ ਹਾਂ ਉੱਥੇ ਜਾ ਕੇ